ਤੇਈ ਨਵੰਬਰ ਦੋ ਹਜ਼ਾਰ ਅੱਠ ਬਾਰ੍ਹਾਂ ਮਈ ਦੋ ਹਜ਼ਾਰ ਬਾਰ੍ਹਾਂ ਚੌਵੀ ਫਰਵਰੀ ਦੋ ਹਜ਼ਾਰ ਸੋਲ੍ਹਾਂ ਅਠਾਈ ਅਪ੍ਰੈਲ ਦੋ ਹਜ਼ਾਰ ਦਸ ਪੱਚੀ ਨਵੰਬਰ ਦੋ ਹਜ਼ਾਰ ਤੇਈ